ਭੰਗੜੇ ਦੀ ਡਰੈੱਸ ਬਹੁਤ ਵਧੀਆ ਹੁੰਦੀ ਹੈ ਇਹਦੇ ਵਿੱਚ ਮੁੰਡਿਆਂ ਨੇ ਕੈਂਠਾ ਪਾਇਆ ਹੁੰਦਾ ਗਲੇ ਵਿੱਚ ਕੁੜਤਾ ਚਾਦਰਾ ਪਾਇਆ ਹੁੰਦਾ ਪੈਰਾਂ ਵਿੱਚ ਜੁੱਤੀ ਤੁਰਲੇ ਵਾਲੀ ਪੱਗ ਇਹਦੇ ਨਾਲ ਬੰਦਾ ਇੰਨਾਂ ਸੋਹਣਾ ਲੱਗਦਾ ਹੈ ਕਿ ਦੂਜੇ ਬੰਦੇ ਨੂੰ ਵੀ ਮੋਹਿਤ ਕਰ ਲੈਂਦਾ ਹੈ ਪੀ ਹਾਂ ਭੰਗੜੇ ਵਾਲੀ ਡਰੈੱਸ ਪਾਉਣੀ ਹੈ ਅਤੇ ਭੰਗੜਾ ਕਰਨਾ ਭੰਗੜਾ ਕਰਨ ਵਿੱਚ ਇੰਨਾਂ ਜ਼ਿਆਦਾ ਮਜ਼ਾ ਆਉਂਦਾ ਨਾ ਉਸ ਡਰੈੱਸ ਨੂੰ ਪਾ ਕੇ ਉਹ ਸਾਡੇ ਪੰਜਾਬ ਦੇ ਵਿਰਸੇ ਦਾ ਵੀ ਹਿੱਸਾ ਬਣੇ ਹੋਏ ਹੈ ਕਿਉਂਕਿ ਪਹਿਲਾਂ ਦੇ ਸਮੇਂ ਵਿੱਚ ਵੀ ਇੱਦਾਂ ਦੇ ਹੀ ਲੋਕ ਆਪਣੀਆਂ ਪੁਸ਼ਾਕਾਂ ਪਾਉਂਦੇ ਸੀ ਅਤੇ ਹੁਣ ਵੀ ਕਈ ਜਗ੍ਹਾ 'ਤੇ ਹੈ ਕਿ ਭੰਗੜੇ ਲਈ ਇੰਨਾਂ ਜ਼ਿਆਦਾ ਪ੍ਰਚਲਿਤ ਹੈਗਾ ਕਿ ਬਹੁਤ ਵਧੀਆ ਤਰੀਕੇ ਨਾਲ ਭੰਗੜਾ ਸਿਖਾਉਂਦੇ ਨੇ ਕਰਦੇ ਨੇ ਹੈਂ ਜਾਗੋਆਂ 'ਤੇ ਵੀ ਲੋੜ ਪੈਂਦੀ ਹੈ ਹੋਰ ਵੀ ਕਈ ਜਿਹੜੇ ਮੇਲੇ ਮੂਲੇ ਹੁੰਦੇ ਹੈ ਜਾਂ ਸ਼ੋਅ ਲੱਗਦੇ ਨੇ ਕੋਈ ਵੀ ਜਿਵੇਂ ਹੁਣ ਤਾਂ ਸਾਰੇ ਨਾਟਕ ਹੀ ਪੰਜਾਬੀ ਬਣਦੇ ਹੈ ਕਿਉਂਕਿ ਪੰਜਾਬ ਦੇ ਵਿ ਵਿਰਸਾ ਜਿਹੜਾ ਇੰਨਾਂ ਵਧੀਆ ਹੈਗਾ ਪੰਜਾਬ ਦੀਆਂ ਕੁੜੀਆਂ ਵੀ ਬਹੁਤ ਵਧੀਆ ਤਰੀਕੇ ਨਾਲ ਡਰੈੱਸਾਂ ਪਾਉਂਦੇ ਜ਼ਿਆਦਾਤਰ ਤਾਂ ਮੁੰਡਿਆਂ ਦੇ ਡਰੈੱਸ ਇੰਨੀ ਵਧੀਆ ਹੁੰਦੀ ਹੈ ਕਿ ਦੂਜੇ ਬੰਦੇ ਨੂੰ ਵੀ ਮੋਹਿਤ ਕਰ ਲੈਂਦੀ ਹੈ ਕਿ ਹਾਂ ਭੰਗੜਾ ਕਰਨਾ ਹੈ ਅਤੇ ਭੰਗੜਾ ਭੰਗੜੇ ਵਾਲੀ ਡਰੈੱਸ ਪਾਉਣੀ ਹੈ